ਆਮ ਜੁਕਾਮ ਦੇ ਇਲਾਜ ਲਈ ਪਿੰਡ ਵਿੱਚ ਜਾਂ ਘਰੇਲੂ ਘਰਾਂ ਦੇ ਵਿੱਚ ਕਾਫ਼ੀ ਜਿਹੜੇ ਉਪਚਾਰ ਆ ਉਹ ਮੰਨੇ ਜਾਂਦੇ ਆ ਆਪਣੇ ਆਪਣੇ ਸਾਰਿਆਂ ਦੇ ਤਰਕ ਆ ਇਹਦੇ ਵਿੱਚ ਇਹਦੇ ਵਿੱਚ ਜਿਸ ਤਰ੍ਹਾਂ ਸਵੇਰੇ ਉੱਠ ਕੇ ਕੋਸਾ ਪਾਣੀ ਪੀਣਾ ਕੋਸੇ ਪਾਣੀ ਦੀ ਭਾਫ਼ ਲੈਣਾ ਇਹਦੇ ਨਾਲ ਕਾਫ਼ੀ ਰਾਹਤ ਮਿਲਦੀ ਹੈ ਅਤੇ ਇੱਕ ਜਿਹੜਾ ਆਮ ਘਰੇ ਘਰਾਂ ਦੇ ਵਿੱਚ ਘਰੇਲੂ ਬਣਾਇਆ ਜਾਂਦਾ ਹੈ ਕਾੜਾ ਉਹਦੇ ਵਿੱਚ ਇੱਕ ਲੌਂਗ ਇੱਕ ਛੋਟਾ ਟੁਕੜਾ ਅਦਰਕ ਦਾ ਇੱਕ ਇਲਾਇਚੀ ਚਾਰ ਪੰਜ ਕਾਲੀ ਮਿਰਚ ਇੱਕ ਛੋਟੀ ਚੁਟਕੀ ਅਜਵੈਨ ਦੀ ਸੌਂਫ ਦਾਲਚੀਨੀ ਮਲੱਠੀ ਅਤੇ ਇੱਕ ਕੱਪ ਪਾਣੀ ਦੇ ਵਿੱਚ ਉਬਾਲ ਕੇ ਚੰਗੀ ਤਰ੍ਹਾਂ ਰਿੰਨ ਕੇ ਉਹਦਾ ਕਾੜਾ ਤਿਆਰ ਕੀਤਾ ਜਾਂਦਾ ਹੈ ਉਹ ਕਾੜਾ ਦਿਨ ਵਿੱਚ ਦੋ ਵਾਰੀ ਪੀਤਾ ਜਾਂਦਾ ਹੈ ਉਹਦੇ ਨਾਲ ਕਾਫ਼ੀ ਰਾਹਤ ਮਿਲਦੀ ਹੈ ਉਹਦੇ ਨਾਲ ਗਲਾ ਖ਼ਰਾਬ ਗਲਾ ਸੋਜ ਗਲਾ ਬੈਠਣਾ ਗਲਾ ਦਰਦ ਹੋਣਾ ਜੁਕਾਮ ਖੰਘ ਰੇਸ਼ਾ ਨੱਕ ਵਗਣਾ ਨੱਕ ਬੰਦ ਰਹਿਣਾ ਇਹ ਸਾਰੀਆਂ ਹੀ ਚੀਜ਼ਾਂ ਉਹਦੇ ਵਿੱਚ ਕਵਰ ਹੋ ਜਾਂਦੀਆਂ ਹਨ ਅਤੇ ਉਸ ਤੋਂ ਇਲਾਵਾ ਸਾਡੇ ਪੁਰਾਣੇ ਸਮੇਂ ਦੇ ਵਿੱਚ ਗੁੜ ਦੇ ਚੌਲ ਬਣਾ ਕੇ ਉਸ ਦੀ ਭਾਫ਼ ਲਈ ਜਾਂਦੀ ਹੈ ਉਹਦੇ ਨਾਲ ਵੀ ਕਾਫ਼ੀ ਰਾਹਤ ਮਿਲਦੀ ਹੈ